ਛੱਬੀ ਅਗਸਤ ਉੱਨੀ ਸੌ ਅੱਸੀ ਉੱਨੀ ਨਵੰਬਰ ਦੋ ਹਜ਼ਾਰ ਸੱਤ ਵੀਹ ਜਨਵਰੀ ਦੋ ਹਜ਼ਾਰ ਦਸ ਸੱਤ ਮਾਰਚ ਵੀਹ ਸੌ ਵੀਹ ਪੰਜ ਮਈ ਵੀਹ ਸੌ ਬਾਈ